ਹੈਲੋ ਹਾਂਜੀ ਸਰ ਤੁਸੀਂ ਆਪਣੇ ਕੋਲ ਜੀ ਦੇਖੋ ਟਾਟਾ ਚਾਰ ਸੌ ਸੱਤ ਵੀ ਹੈਗੇ ਨੇ ਹਾਂਜੀ ਛੋਟੀਆਂ ਗੱਡੀਆਂ ਵੀ ਹੈਗੀਆਂ ਨੇ ਹਾਂਜੀ ਹਾਂਜੀ ਤੁਹਾਨੂੰ ਕੀ ਰਿਕੁਾਇਰਮੈਂਟ ਕੀ ਹੈ ਤੁਹਾਡੀ ਜੀ

ਹਾਂਜੀ ਹਾਂਜੀ ਠੀਕ ਹੈ ਸਰ ਠੀਕ ਹੈ ਹਾਂਜੀ ਜਿੱਦਾਂ ਤੁਹਾਨੂੰ ਅੱਜ ਲੋੜ ਆ ਅਸੀਂ ਭੇਜ ਸਕਦੇ ਹਾਂ ਜੀ ਹੁਣ ਵੀ ਸਾਡੇ ਕੋਲ ਅਵੇਲੇਬਲ ਹੈਗੇ ਨੇ ਤੁਸੀਂ ਲੋਕੇਸ਼ਨ ਦੱਸੋ ਕਿ ਕਿੱਥੇ ਭੇਜਣੀ ਆ ਜੀ ਗੱਡੀ ਅਸੀਂ ਲੁਧਿਆਣਾ ਤੋਂ ਗੱਲ ਕਰਦੇ ਹਾਂ ਗਿੱਲ ਚੌਂਕ ਵਾਲੀ ਸਾਈਡ ਹਾਂਜੀ ਬਿਲਕੁਲ ਜੀ ਹਾਂਜੀ ਅਸੀਂ ਪੂਰੇ ਪੰਜਾਬ ਦੇ ਵਿੱਚ ਆ ਜੀ ਸਾਡੀਆਂ ਹਾਂਜੀ ਹਾਂਜੀ ਤੁਸੀਂ ਸਾਨੂੰ ਕਾਲ ਕਰੋ ਜਿੱਥੇ ਤੁਹਾਨੂੰ ਗੱਡੀ ਦੀ ਜ਼ਰੂਰਤ ਆ ਤੁਸੀਂ ਬੁੱਕ ਬੁੱਕ ਕਰੋ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਪੇਮੈਂਟ ਸਾਡੀ ਕਿਲੋਮੀਟਰ ਦੇ ਹਿਸਾਬ ਨਾਲ ਆ ਜੀ ਪੰਦਰਾਂ ਰੁਪਏ ਪਰ ਕਿਲੋਮੀਟਰ ਹੈ ਜੀ ਹਾਂਜੀ ਸਰ ਜਿੱਦਾਂ ਤੁਸੀਂ ਵਹੀਕਲ ਜਿਹੜਾ ਵੀ ਸਲੈਕਟ ਕਰਦੇ ਜਦੋਂ ਤੁਸੀਂ ਕਾਰ ਲੈ ਕੇ ਜਾ ਰਹੇ ਹੋ ਦਸ ਦਸ ਰੁਪਏ ਕਿਲੋਮੀਟਰ ਆ ਅਤੇ ਜਿੱਦਾਂ ਤੁਸੀਂ ਵੱਡੀ ਗੱਡੀ ਲੈਣੀ ਆ ਟਰਾਂਸਪੋਰਟੇਸ਼ਨ ਲਈ ਕੋਈ ਸਮਾਨ ਲੈ ਕੇ ਜਾਣਾ ਉਹਦੇ ਲਈ ਪੰਦਰਾਂ ਵੀਹ ਰੁਪਏ ਕਿਲੋਮੀਟਰ ਪੈ ਜਾਂਦਾ ਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ

ਹਾਂਜੀ ਉਹ ਤਾਂ ਤੁਹਾਨੂੰ ਇਹ ਆ ਵੀ ਪਰ ਕਿਲੋਮੀਟਰ ਦੇ ਹਿਸਾਬ ਨਾਲ ਪੈ ਜਾਣਾ ਜੀ ਜੇ ਤੁਸੀਂ ਮਤਲਬ ਹਾਂਜੀ ਤੁਸੀਂ ਘੰਟਿਆਂ ਲਈ ਵੀ ਬੁੱਕ ਕਰ ਸਕਦੇ ਹੋ ਨਾ ਉਹਦੇ ਚਾਰਜਸ ਅਲੱਗ ਨੇ ਹਾਂਜੀ ਹਾਂਜੀ ਉਹ ਤਾਂ ਫਿਰ ਤੁਸੀਂ ਉੱਥੋਂ ਦੁਬਾਰਾ ਵੀ ਬੁੱਕ ਕਰ ਸਕਦੇ ਹੋ ਨਾ ਨਹੀਂ ਸਰ ਦੇਖੋ ਜਿੱਦ ਜਿੱਦਾਂ ਤੁਸੀਂ ਗੱਡੀ ਬੁੱਕ ਕਰ ਲਈ ਸਾਡੀ ਤੁਸੀਂ ਆਪ ਆਪਣੀ ਲੋਕੇਸ਼ਨ 'ਤੇ ਚਲੇ ਗਏ ਜੇ ਤਾਂ ਤੁਸੀਂ ਪੰਜਾਬ ਦੇ ਵਿੱਚ ਹੀ ਹੋ ਤਾਂ ਉੱਥੋਂ ਸਾਡੀ ਗੱਡੀ ਦੁਬਾਰਾ ਬੁੱਕ ਹੋ ਸਕਦੀ ਆ ਹਾਂਜੀ ਹਾਂਜੀ ਜੇ ਤੁਸੀਂ ਅਪ ਡਾਊਨ ਕਰਨਾ ਹਾਂਜੀ ਸਰ ਤੁਸੀਂ ਅਪ ਡਾਊਨ ਵੀ ਕਰ ਸਕਦੇ ਹੋ ਗੱਡੀ ਪ ਪਰਮਾਨੈਂਟ ਵੀ ਬੁੱਕ ਕਰ ਸਕਦੇ ਹੋ ਦੋ ਦਿਨ ਹਾਂਜੀ ਹਾਂਜੀ ਸਰ ਦੋ ਦਿਨ ਲਈ ਵੀ ਬੁੱਕ ਕਰ ਸਕਦੇ ਹੋ ਨਾ ਹਾਂਜੀ ਸਰ ਤੁਸੀਂ ਸਾਡੇ ਓਫਿਸ ਆ ਸਕਦੇ ਹੋ ਜਾਂ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਉੱਥੇ ਪਹੁੰਚ ਪਹੁੰਚ ਜਾਂਦਾ ਸਾਡਾ ਬੰਦਾ ਹਾਂਜੀ ਸਰ ਹਾਂਜੀ ਸਰ ਬਿਲਕੁਲ ਬਿਲਕੁਲ ਜੇ ਤੁਸੀਂ ਪੱਕਾ ਮਤਲਬ ਪਰਮਾਨੈਂਟ ਆਪਣੇ ਬਿਜ਼ਨਸ ਲਈ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਉਹਦੇ 'ਤੇ ਡਿਸਕਾਊਂਟ ਡਿਸਕਾਊਂਟ ਵੀ ਦਿਆਂਗੇ ਜੀ ਪੈਕਜ ਹੁੰਦੇ ਆ ਸਾਡੇ ਹਾਂਜੀ ਸਰ ਹਾਂਜੀ ਤੁਸੀਂ ਆਪਣੇ ਹਾਂਜੀ ਐ ਐਡਰੈਸ ਦੇ ਦਿਓ ਜੀ ਸਾਡਾ ਬੰਦਾ ਤੁਹਾਨੂੰ ਅਪਰੋਚ ਕਰੇਗਾ ਓਕ ਓਕੇ ਸਰ ਥੈਂਕ ਯੂ ਜੀ